ਸਤਿ ਸ਼੍ਰੀ ਅਕਾਲ ਮੇਰਾ ਨਾਮ ਅਰਮਾਨਦੀਪ ਸਿੰਘ ਹੈ ਮੈਂ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ ਮੈਨੂੰ ਪੇਂਟਿੰਗ ਬਹੁਤ ਵਧੀਆ ਲੱਗਦੀ ਹੈ ਜਿਸ ਨਾਲ ਮੈਂ ਬਹੁਤ ਵਧੀਆ ਮਹਿਸੂਸ ਕਰਦਾ ਪੇਂਟਿੰਗ ਕਰਨ ਨਾਲ ਪੇਂਟਿੰਗ ਕਰਨ ਦੇ ਬਹੁਤ ਹੀ ਫਾਇਦੇ ਹਨ ਜਿਸ ਨਾਲ ਸਾਡਾ ਟਾਈਮ ਹੀ ਵਧੀਆ ਲੰਘ ਜਾਂਦਾ ਹੈ ਅਤੇ ਸਾਨੂੰ ਸਮਾਂ ਬਹੁਤ ਵਧੀਆ ਵਰਤੀ ਬਬੀਤ ਹੁੰ ਬਤੀਤ ਹੁੰਦਾ ਹੈ ਅਤੇ ਸਾਨੂੰ ਬਹੁਤ ਮਸੂ ਵਧੀਆ ਮਹਿਸੂਸ ਹੁੰਦਾ ਹੈ ਕਿ ਪੇਂਟਿੰਗ ਕਰਨ ਨਾਲ ਸਾਡੀ ਸਮੱਸਿਆਵਾਂ ਨੂੰ ਬਹੁਤ ਘੱਟ ਪੇਂਟਿੰਗ ਨਾਲ ਸਾਡਾ ਬਹੁਤ ਮਨ ਲੱਗਾ ਪੇਂਟਿੰਗ ਕਰਨ ਨਾਲ ਸਾਡਾ ਬਹੁਤ ਹੀ ਮਾ ਸਮਾਂ ਬਤੀਤ ਹੁੰਦਾ ਹੈ ਪੇਂਟਿੰਗ ਸਾਨੂੰ ਉਹ ਹਰ ਇੱਕ ਨੂੰ ਕਰਨੀ ਚਾਹੀਦੀ ਹੈ ਜਿਸ ਨਾਲ ਜਿਸ ਨਾਲ ਸਾਡਾ ਟੈਮ ਵਧੀਆ ਲੰਘ ਜਾਂਦਾ ਹੈ ਤਾਂ